ਭੰਗੜਾ ਇੱਕ ਪੰਜਾਬ ਦਾ ਮਹਾਨ ਲੋਕ ਨਾਚ ਹੈ ਭੰਗੜੇ ਨਾਲ ਹਰ ਫੰਕਸ਼ਨ ਦੀ ਸ਼ਾਨ ਵਧਾਈ ਜਾ ਸਕਦੀ ਹੈ ਭੰਗੜਾ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਮਸ਼ਹੂਰ ਨਾਚ ਮੰਨਿਆ ਜਾਂਦਾ ਹੈ ਲੋਕ ਆਪਣੇ ਵਿਆਹਾਂ ਅਤੇ ਹੋਰ ਫੰਕਸ਼ਨਾਂ ਦੀ ਸ਼ਾਨ ਨੂੰ ਵਧਾਉਣ ਦੇ ਲਈ ਭੰਗੜਾ ਜ਼ਰੂਰ ਕਰਦੇ ਹਨ ਭੰਗੜੇ ਦੇ ਨਾਲ ਨਾਲ ਗਿੱਧੇ ਨੂੰ ਵੀ ਬਹੁਤ ਸਾਰੀ ਮਹੱਤਤਾ ਦਿੱਤੀ ਜਾਂਦੀ ਹੈ